ਹੈਲੋ ਹੈਲੋ ਹਾਂਜੀ ਹਾਂਜੀ ਮੈਮ ਬੋਲੋ ਹਾਂ ਠੀਕ ਹਾਂ ਤੁਸੀਂ ਦੱਸੋ ਹਾਂਜੀ ਮੈਮ ਬੋਲੋ ਹੈਲੋ ਹਾਂਜੀ ਮੈਮ ਮੈਂ ਇਹ ਪੁੱਛ ਰਹੀ ਸੀ ਜੋਰਾਵਰ ਨੂੰ ਸਕੂਲ ਪਾਉਣਾ ਹੁਣ ਉਹ ਟੈਂਨਥ ਵਿੱਚ ਅੱਗੇ ਟੈਂਨਥ ਵਾਸਤੇ ਐਡਮਿਸ਼ਨ ਏਟਥ 'ਚ ਹੋ ਗਿਆ ਤਾਂ ਮੈਂ ਸੋਚਿਆ ਵੀ ਚਲੋ ਹੁਣ ਅੱਗੇ ਉਹਨੂੰ ਸਕੂਲ ਚੇਂਜ ਕਰਦਾ ਤਾਂ ਤੁਹਾਨੂੰ ਕੀ ਲੱਗਦਾ ਬਈ ਕਿਹੜਾ ਸਕੂਲ ਬੈਸਟ ਹੋਊਗਾ ਪਹਿਲਾਂ ਤੁਹਾਨੂੰ ਪਤਾ ਹੀ ਉਹ ਕਿਹੜੇ ਸਕੂਲ 'ਚ ਪੜ੍ਹਦਾ ਤਾਂ ਹੁਣ ਕਿਹੜਾ ਸਕੂਲ ਬੈਸਟ ਹੋਊਗਾ ਆਪਣੇ ਇਥੇ ਆਪਣੇ ਡਿਸਟਰਿਕਟ ਦੇ ਵਿੱਚ ਤੁਸੀਂ ਦੇਖੋ ਤੁਹਾਨੂੰ ਕਿਹੜਾ ਲੱਗਦਾ ਹਾਂਜੀ

ਹਾਂਜੀ ਆਰਮੀ ਸਕੂਲ 'ਚ ਤਾਂ ਮੈਨੂੰ ਲੱਗਦਾ ਪੰਜਾਬੀ ਮੈਂ ਪਤਾ ਕਰਦੀ ਹਾਂ ਜੇ ਅਗਰ ਤਾਂ ਪੰਜਾਬੀ ਹੈ ਤਾਂ ਫਿਰ ਤਾਂ ਮੈਂ ਉੱਥੇ ਲਗਾ ਦੇਵਾਂਗੀ ਨਹੀਂ ਤਾਂ ਮੈਂ ਕੋਈ ਹੋਰ ਦੇਖਦੀ ਹਾਂ ਉਸ ਤੋਂ ਇਲਾਵਾ ਮੈਨੂੰ ਆਪਸ਼ਨ 'ਚ ਹੋਰ ਵੀ ਸਕੂਲ ਰੱਖਣਾ ਪੈਣਾ ਨਾ ਤਾਂ ਹਾਂ ਤਾਂ ਮੈਨੂੰ ਥੋੜ੍ਹਾ ਜਿਹਾ ਇਹੀ ਹੁੰਦਾ ਸੀਗਾ ਕਿ ਪੰਜਾਬੀ ਜ਼ਰੂਰ ਹੋਵੇ ਕਿਉਂਕਿ ਆਪਾਂ ਪੰਜਾਬ 'ਚ ਰਹਿੰਦੇ ਹਾਂ ਤਾਂ ਪੰਜਾਬੀ ਕੰਪਲਸਰੀ ਆ ਨਹੀਂ ਤਾਂ ਅੱਗੇ ਵੀ ਬੱਚਿਆਂ ਨੂੰ ਫਿਰ ਪ੍ਰੋਬਲਮ ਆਉਂਦੀ ਆ ਅਦਰਵਾਈਜ਼ ਹਾਂਜੀ ਤਾਂ ਹਾਂਜੀ ਬਿਲਕੁਲ ਅਤੇ ਤੁਸੀਂ ਵੀ ਤਾਂ ਕਹਿੰਦੇ ਸੀ ਹਾਂਜੀ ਹਾਂਜੀ ਬੋਲੋ ਰੈਫਰੈਂਸ ਦਿੰਦੇ ਹਾਂ ਨਾ ਹਾਂਜੀ ਠੀਕ ਏ ਹਾਂਜੀ ਅਤੇ ਬਾਕੀ ਇਹ ਚੀਜ਼ ਹੈ ਨਾ ਵੀ ਸਕੂਲ ਦੇ ਵਿੱਚ ਥੋੜ੍ਹਾ ਬੱਚੇ ਨੂੰ ਅਲਾਓ ਕਰਨ ਪੰਜਾਬੀ ਬੋਲਣਾ ਮੈਂ ਇਹ ਚੀਜ਼ ਵੀ ਦੇਖਣੀ ਹੈ ਬੱਚਿਆਂ ਨੂੰ ਬਿਲਕੁਲ ਅਲਾਉ ਨਹੀਂ ਕਰਦੇ ਸਕੂਲ 'ਚ ਪੰਜਾਬੀ 'ਚ ਗੱਲ ਕਰਨਾ ਤਾਂ ਅਸੀਂ ਘਰ ਚ ਤਾਂ ਪੰਜਾਬੀ ਬੋਲਦੇ ਹਾਂ ਬੱਚਿਆਂ ਨੂੰ ਸਿਖਾਉਣੀ ਜ਼ਰੂਰੀ ਹੈ ਤਾਂ ਫਿਰ ਉਹ ਵੀ ਇੱਦਾਂ ਵੀ ਕੋਈ ਸਕੂਲ ਦੇਖਾਂਗੇ ਜਿਵੇਂ ਹੈਰੀਟੇਜ ਸਕੂਲ ਵੀ ਹੈ ਇਧਰ ਹੋਲੀ ਹਾਰਟ ਵੀ ਹੈ ਉਧਰ ਕਹਿੰਦੇ ਡੀ ਪੀ ਐਸ ਵੀ ਅੱਛਾ ਅਬੋਹਰ 'ਚ ਆਪਣੇ ਸ਼ਹਿਰ ਦਾ ਅਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਹਾਂਜੀ ਅਤੇ ਮੈਂ ਇਹੀ ਸੋਚਦੇ ਸੀ ਕਿ ਬਈ ਮੈਂ ਇੱਦਾਂ ਹੀ ਕੋਈ ਸਕੂਲ ਦੇਖਦੀ ਹਾਂ ਹੈਰੀਟੇਜ 'ਚ ਵੀ ਪੰਜਾਬੀ ਦੀ ਪੰਜਾਬੀ ਹੈ ਇੰਨਾ ਕੁ ਤਾਂ ਮੈਨੂੰ ਪੱਕਾ ਪਤਾ ਅਤੇ ਵਿਜਿਟਮ ਕੋਂਨਵੈਂਟ 'ਚ ਵੀ ਹੈ ਇਸ ਸਕੂਲ ਥੋੜ੍ਹੇ ਅੱਛੇ ਆਤਮ ਵਲਬ 'ਚ ਵੀ ਹੈ ਤੁਹਾਡਾ ਬੇਟਾ ਥੋੜ੍ਹਾ ਜਿਹਾ ਮੇਰੇ ਬੇਟੇ ਤੋਂ ਵੱਡਾ ਤਾਂ ਮੈਨੂੰ ਐਵੇਂ ਆ ਤੁਹਾਨੂੰ ਜ਼ਿਆਦਾ ਨੌਲੇਜ ਹੈ ਤਾਂ ਕਰਕੇ ਮੈਂ ਤੁਹਾਡੇ ਤੋਂ ਸਲਾਹ ਲੈ ਰਹੀ ਸੀਗੀ ਠੀਕ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਚਲੋ ਮੈਂ ਸੋਚਦੀ ਆ ਇਸ ਬਾਰੇ ਫਿਰ ਵੀ ਮੈਂ ਹੋਰ ਸੋਚਦੀ ਹਾਂ ਕਿ ਕਿਹੜਾ ਸਕੂਲ ਜ਼ਿਆਦਾ ਵਧੀਆ ਉਸ ਹਿਸਾਬ ਨਾਲ ਫਿਰ ਮੈਂ ਬੱਚੇ ਦੀ ਐਡਮਿਸ਼ਨ ਕਰਾਉਂਦੀ ਹਾਂ ਮੇਨ ਪੰਜਾਬੀ ਦੇਖਣਾ ਸੀ ਬਾਕੀ ਸਬਜੈਕਟਸ ਤਾਂ ਸਾਰੇ ਸਕੂਲ ਅੱਛੇ ਕਰਾਉਂਦੇ ਹੀ ਆ ਪੰਜਾਬੀ ਨੂੰ ਥੋੜ੍ਹਾ ਪਿੱਛੇ ਰੱਖਦੇ ਆ ਤਾਂ ਕਰਕੇ ਮੈਂ ਇਹ ਸੋਚ ਰਹੀ ਸੀਗੀ ਕਿ ਤੁਹਾਡੇ ਤੋਂ ਸਲਾਹ ਲੈ ਲਵਾਂ ਕਿਉਂਕਿ ਤੁਹਾਡਾ ਐਕਸਪੀਰੀਅੰਸ ਥੋੜ੍ਹਾ ਜਿਹਾ ਮੇਰੇ ਨਾਲੋਂ ਜ਼ਿਆਦਾ ਏ ਇਸ ਚੀਜ਼ 'ਚ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ